ਪੰਜਾਬ ਦਾ ਜੋ ਮਨੋਰੰਜਨ ਦ੍ਰਿਸ਼ ਹੈ ਭਾਰਤ ਦੇ ਦੂਜੇ ਰਾਜਾਂ ਨਾਲੋਂ ਕਿਵੇਂ ਤੁਲਨਾ ਕਰਦਾ ਹੈ ਉਹਦੇ ਵਿੱਚ ਕੀ ਹੈ ਕਿ ਪੰਜਾਬ ਦਾ ਜੋ ਮਨੋਰੰਜਨ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਪੰਜਾਬੀ ਗਾਣਿਆਂ ਦੀ ਜੋ ਪੰਜਾਬੀ ਗਾਣੇ ਹੈ ਉਹ ਪੰਜਾਬ ਵਿੱਚ ਤਾਂ ਮਸ਼ਹੂਰ ਹੈ ਹੀ ਹੈ ਉਸ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਹੋਰ ਦੇਸ਼ਾਂ ਜਿਵੇਂ ਕਨੇਡਾ ਅਮੈਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਹੋਰ ਵੀ ਬਹੁਤ ਸਾਰੇ ਦੇਸ਼ ਜਿੱਥੇ ਪੰਜਾਬੀ ਗਾਣੇ ਪੰਜਾਬੀ ਮਨੋਰੰਜਨ ਦੇ ਜੋ ਸਾਧਨ ਹੈ ਵਰਤੇ ਜਾਂਦੇ ਹੈ ਅਤੇ ਉਸ ਤੋਂ ਇਲਾਵਾ ਜੇ ਆਪਾਂ ਪੰਜਾਬੀ ਗਾਣਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜੋ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਉਹਦੇ ਗਾਣੇ ਵੀ ਬੜੇ ਸੁਣੇ ਜਾਂਦੇ ਹੈ ਪੂਰੀ ਦੁਨੀਆਂ ਦੇ ਵਿੱਚ ਉਸ ਤੋਂ ਇਲਾਵਾ ਜੇ ਗੱਲ ਕਰੀਏ ਪੰਜਾਬੀ ਗਾਣਿਆਂ ਦੀ ਤਾਂ ਉਹ ਜੋ ਸਾਡੀ ਹਿੰਦੀ ਇੰਡਸਟਰੀ ਹੈ ਬੋਲੀਵੁੱਡ ਇੰਡਸਟਰੀ ਹੈ ਉਹਦੇ ਵਿੱਚ ਵੀ ਜੋ ਪੰਜਾਬੀ ਗਾਣੇ ਚਲਾਏ ਜਾਂਦੇ ਹੈ ਤਾਂ ਉਸ ਤੋਂ ਇਲਾਵਾ ਜੋ ਪੰਜਾਬੀ ਮਨੋਰੰਜਨ ਦੇ ਹੋਰ ਸਾਧਨ ਜਿਵੇਂ ਕਿ ਫਿਲਮਾਂ ਉਹਨਾਂ ਦੇ ਵਿੱਚ ਵੀ ਪੰਜਾਬੀ ਗਾਣੇ ਹੁੰਦੇ ਹੈ ਤਾਂ ਬਹੁਤ ਅੱਛਾ ਸਾਧਨ ਹੈ ਪੰਜਾਬੀ ਮਨੋਰੰਜਨ ਦਾ ਪੰਜਾਬੀ ਫਿਲਮਾਂ ਹੋ ਗਈਆਂ ਉਸ ਤੋਂ ਬਾਅਦ ਪੰਜਾਬੀ ਪੰਜਾਬ ਦੇ ਮਨੋਰੰਜਨ ਦੇ ਹੋਰ ਵੀ ਜਿੰਨੇ ਸਾਧਨ ਹਨ ਜਿਵੇਂ ਕਿ ਮੇਲੇ ਹੋ ਗਏ ਪੰਜਾਬ ਦੇ ਤਿਉਹਾਰ ਹੋ ਗਏ ਤਾਂ ਉਹ ਜੋ ਪੰਜਾਬ ਦੇ ਮਨੋਰੰਜਨ ਹੈ ਉਹ ਬਾਕੀ ਭਾਰਤ ਦੇ ਬਾਕੀ ਰਾਜਾਂ ਤੋਂ ਬੜੇ ਵੱਖਰੇ ਅਤੇ ਵਿਲੱਖਣ ਅਤੇ ਬੜੇ ਅਨੰਦਮਈ ਹੈ ਤਾਂ ਇਸ ਤਰ੍ਹਾਂ ਜੋ ਪੰਜਾਬ ਦੇ ਮਨੋਰੰਜਨ ਦੇ ਸਾਧਨ ਹੈ ਜਾਂ ਮਨੋਰੰਜਨ ਦੇ ਦ੍ਰਿਸ਼ ਹੈ ਭਾਰਤ ਦੇ ਹੋਰ ਰਾਜਾਂ ਨਾਲੋਂ ਬੜੇ ਅਲੱਗ ਅਤੇ ਵੱਖਰੇ ਹੈ

ਜਾਂ ਪੰਜਾਬ ਦੇ ਤਿਉਹਾਰ ਹੋ ਗਏ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਸੁਣਦੇ ਆ ਅਤੇ ਉਹਨਾਂ ਦੇ ਜੋ ਪ੍ਰਸ਼ੰਸਾ ਕਰਦੇ ਹੈ ਤਾਂ ਜੋ ਪੰਜਾਬ ਦੇ ਵਿੱਚ ਹੋਰ ਵੀ ਜਿਵੇਂ ਮਨੋਰੰਜਨ ਦੇ ਸਾਧਨ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਮਨੋਰੰਜਨ ਦੇ ਸਾਧਨ ਜਿਵੇਂ ਖੇਡਾਂ ਹੋ ਗਈਆਂ ਪੰਜਾਬ ਪੰਜਾਬ ਦੀਆਂ ਕਬੱਡੀ ਖੇਡ ਹੋ ਗਈ ਉਹ ਵੀ ਇੱਕ ਮਨੋਰੰਜਨ ਦਾ ਸਾਧਨ ਹੈ ਖੋ ਖੋ ਹੋ ਗਈ ਪੰਜਾਬ ਦੀ ਉਹ ਵੀ ਇਕ ਮਨੋਰੰਜਨ ਦਾ ਸਾਧਨ ਹੈ ਹੋਰ ਵੀ ਗੇਮਾਂ ਜਾਂ ਹੋਰ ਵੀ ਜੋ ਪੰਜਾਬ ਦੇ ਮਨੋਰੰਜਨ ਦੇ ਸਾਧਨ ਹੈ ਜੋ ਬਾਕੀ ਰਾਜਾਂ ਨਾਲੋਂ ਸਾਨੂੰ ਵਿਲੱਖਣਤਾ ਪ੍ਰਦਾਨ ਕਰਦੇ ਹੈ ਸੋ ਪੰਜਾਬ ਦੇ ਵਿੱਚ ਜੋ ਸਾਧਨ ਹੈ ਉਹਨਾਂ ਦੀ ਅਸੀਂ ਬੜੀ ਪ੍ਰਸ਼ੰਸਾ ਕਰਦੇ ਐ